ਟੈਕਨੋਲਜੀ ਨੇ ਹੋਟਲ ਉਦੋਯੋਗ ਦੀ ਕਈ ਤਰ੍ਹਾਂ ਨਾਲ ਮਦਦ ਕੀਤੀ ਹੈ ਅੱਜ ਕੱਲ੍ਹ ਦੇ ਸਮੇਂ ਵਿਚ ਟੈਕਨੋਲਜੀ ਮਨੁੱਖ ਨੂੰ ਕਈ ਤਰ੍ਹਾਂ ਨਾਲ ਮਦਦ ਕਰਦੀ ਹੈ ਟੈਕਨੋਲਜੀ ਰਾਹੀਂ ਮਨੁੱਖ ਘਰ ਬੈਠ ਕੇ ਹੀ ਕਿਸੀ ਥਾਂ ਦਾ ਹੋਟਲ ਬੁੱਕ ਕਰ ਸਕਦਾ ਹੈ ਕਿਉਂਕਿ ਟੈਕਨੋਲਜੀ ਰਾਹੀਂ ਮਨੁੱਖ ਆਪਣੇ ਫੋਨ ਵੀ ਹੋਟਲ ਬੁਕਿੰਗ ਐਪ ਡਾਊਨਲੋਡ ਕਰਦਾ ਹੈ ਜਿਸ ਵਿੱਚ ਕਈ ਤਰਾਂ ਦੀ ਹੋਟਲ ਬੁਕਿੰਗ ਐਪ ਹੁੰਦੇ ਹਨ ਜਿਵੇਂ ਕਿ ਮੇਕ ਮਾਈ ਟ੍ਰਿਪ ਡੋਟ ਕੋਮ ਬੁਕਿੰਗ ਡੋਟ ਕੋਮ ਆਦਿ ਜਿਨਾਂ ਦੀ ਮਦਦ ਨਾਲ ਮਨੁੱਖ ਉਸ ਥਾਂ ਦਾ ਹੋਟਲ ਬੁੱਕ ਕਰਦਾ ਹੈ ਅਤੇ ਉਸ ਹੋਟਲ ਦੇ ਕਮਰੇ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਦਾ ਹੈ ਜਿਸ ਕਮਰੇ ਨੂੰ ਉਹ ਆਪਣੇ ਲਈ ਬੁੱਕ ਕਰਨਾ ਚਾਹੁੰਦਾ ਹੈ ਅਤੇ ਉਸ ਹੋਟਲ ਬੁਕਿੰਗ ਐਪ ਵਿਚ ਹੀ ਉਸ ਕਮਰੇ ਦੇ ਪੈਸੇ ਵੀ ਪਤਾ ਲੱਗ ਜਾਂਦੇ ਹਨ ਕਿ ਉਸ ਕਮਰੇ ਦੀ ਕਿੰਨੀ ਕੀਮਤ ਹੈ ਤਾਂ ਕਿ ਮਨੁੱਖ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਹੋਟਲ ਬੁੱਕ ਕਰਨ ਵਿੱਚ ਜਿਵੇਂ ਕਿ ਕਿਸੇ ਮਨੁੱਖ ਨੇ ਆਪਣੇ ਪਰਿਵਾਰ ਨਾਲ ਵੈਸ਼ਨੋ ਦੇਵੀ ਘੁੰਮਣ ਜਾਣਾ ਹੁੰਦਾ ਹੈ ਤਾਂ ਉਹ ਘਰ ਬੈਠ ਕੇ ਹੀ ਵੈਸ਼ਨੋ ਦੇਵੀ ਦੇ ਹੋਟਲ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਹੈ ਤਾਂ ਕਿ ਉਸ ਨੂੰ ਉੱਥੇ ਜਾ ਕੇ ਕਿਸੀ ਵੀ ਸਮੱਸਿਆ ਦਾ ਸਾਮਣਾ ਨਾ ਕਰਨਾ ਪਵੇ ਟੈਕਨੋਲਜੀ ਦੀ ਮਦਦ ਨਾਲ ਉਸ ਹੋਟਲ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਂਦਾ ਹੈ ਜਿਸ ਨੂੰ ਉਹ ਬੁੱਕ ਕਰਨ ਵਿੱਚ ਬੁੱਕ ਕਰਨਾ ਚਾਹੁੰਦਾ ਹੈ ਅਤੇ ਉਸ ਕਮਰੇ ਦੀ ਕਿੰਨੀ ਕੀਮਤ ਹੁੰਦੀ ਹੈ ਅਤੇ ਉਸ ਕਮਰੇ ਉਸ ਲਈ ਕਿੰਨਾ ਸਹਾਈ ਹੁੰਦਾ ਇਹ ਵੀ ਉਸਨੂੰ ਪਦਤ ਲੱਗ ਜਾਂਦੀ ਹੈ